ਪਸ਼ੂਆਂ ਦੇ ਪੂਜਣੀਆ ਸੰਭਾਲ ਲਈ ਆ ਕੁਝ ਤਰੀਕੇ ਅਪਣਾਏ ਜਾ ਸਕਦੇ ਹਨ ਪਹਿਲਾ ਸਹੀ ਆਹਾਰ ਅਤੇ ਪਾਣੀ ਪਸ਼ੂਆਂ ਨੂੰ ਪੂਰਾ ਪੋਸ਼ਟਿਕ ਖੁਰਾਕ ਮਿਲਣੀ ਚਾਹੀਦੀ ਹੈ ਹਰੇ ਚਾਰੇ ਦਾਣੇ ਅਤੇ ਵਧੀਆ ਗੁਣਵੱਤਾ ਵਾਲਾ ਚਾਰਾ ਉਹਨਾਂ ਦੀ ਤੰਦਰੁਸਤੀ ਲਈ ਲਾਜ਼ਮੀ ਹੈ ਦੂਸਰਾ ਵੈਟਰਨਰੀ ਦੇਖਭਾਲ ਪਸ਼ੂਆਂ ਦੀ ਸਮੇਂ ਸਮੇਂ 'ਤੇ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਟੀਕਾਕਰਨ ਕਰਵਾਉਣਾ ਅਤੇ ਬਿਮਾਰੀਆਂ ਤੋਂ ਬਚਾਅ ਲਈ ਉਹਨਾਂ ਦੀ ਸਿਹਤ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੀਸਰਾ ਸਾਫ ਸੁਥਰੀ ਰਹਿਣ ਬੈਠਣ ਦੀ ਥਾਂ ਪਸ਼ੂਆਂ ਲਈ ਸ਼ੁੱਧ ਹਵਾਦ ਹਵਾਦਾਰ ਅਤੇ ਸੁੱਕੀ ਥਾਂ ਮੁਹੱਈਆ ਕਰਵਾਈ ਕਰਵਾਉਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਕੋਈ ਇਨਫੈਕਸ਼ਨ ਨਾ ਹੋਵੇ ਚੌਥਾ ਕੁਦਰਤੀ ਅਤੇ ਵੈਜੀਟੇਰੀਅਨ ਚਾਰਾ ਜਿੱਥੇ ਤੱਕ ਸੰਭਵ ਹੋਵੇ ਉਹਨਾਂ ਨੂੰ ਰਸਾਇਣ ਮੁਕਤ ਅਤੇ ਕੁਦਰਤੀ ਚਾਰਾ ਦੇ ਦੇਣਾ ਉਹਨਾਂ ਦੀ ਤੰਦਰੁਸਤੀ ਲਈ ਵਧੀਆ ਹੁੰਦਾ ਹੈ ਪੰਜਵਾਂ ਸਭ ਤੋਂ ਜ਼ਰੂਰੀ ਪਿਆਰ ਅਤੇ ਸਨਮਾਨ ਪਸ਼ੂਆਂ ਨਾਲ ਨਰਮੀ ਅਤੇ ਪਿਆਰ ਨਾਲ ਵਿਵਹਾਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਮਾਰਨਾ ਪਿੱਟਣਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਨੂੰ ਵੀ ਬੁਰਾ ਵਿਵਹਾਰ ਪਸੰਦ ਨਹੀਂ ਹੁੰਦਾ